ਪੰਜਾਬ ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਭੰਗੜੇ ਦੀ ਇੱਕ ਖ਼ਾਸ ਵਰਦੀ ਹੈ ਇਸ ਵਰਦੀ ਨੂੰ ਵਰਤ ਕੇ ਪਾ ਕੇ ਲੋਕ ਮੇਲੇ ਅਖਾੜੇ ਵਿੱਚ ਜਾਂਦੇ ਹਨ ਇਹ ਵਰਦੀ ਲੰਬਾ ਕੁੜਤਾ ਲੰਬਾ ਚਾਦਰਾ ਨੋਕ ਵਾਲੀ ਜੁੱਤੀ ਤੁਰਲੇ ਵਾਲੀ ਪਗੜੀ ਹੁੰਦੀ ਹੈ ਅਤੇ ਗਲ ਵਿੱਚ ਕੈਂਠਾ ਸੰਮਾਂ ਵਾਲੀ ਡਾਂਗ ਮੋਢੇ ਉੱਤੇ ਰੱਖ ਕੇ ਉੱਤੇ ਲੋਈ ਦੀ ਗੈਂਤੀ ਆਮ ਪੰਜਾਬੀ ਖ਼ਾਸ ਵਿਸਾਖੀ ਵਾਲੇ ਦਿਨ ਜਿੱਥੇ ਮੇਲੇ ਅਖਾੜੇ ਲੱਗਦੇ ਹਨ ਉੱਥੇ ਆਮ ਅਖਾਣ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਮੇਲੇ ਵਿੱਚ ਪਹੁੰਚ ਕੇ ਲੋਕ ਨਾਚ ਅਤੇ ਬੋਲੀਆਂ ਪਾਉਂਦੇ ਅਤੇ ਜੋਸ਼ ਨਾਲ ਭੰਗੜਾ ਪਾਉਂਦੇ ਅਤੇ ਖੁਸ਼ੀ ਮਨਾਉਂਦੇ ਹਨ